ਮੇਰਾ ਨਾਮ ਸਲੋਨੀ ਹੈ ਅਤੇ ਮੈਂ ਮੋਹਾਲੀ ਜ਼ਿਲ੍ਹੇ ਵਿੱਚ ਪਿੰਡ ਮੱਛਲੀ ਕਲਾਂ 'ਚ ਰਹਿਣ ਵਾਲੀ ਹਾਂ ਮੈਂ ਆਪਣੇ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਦਸਵੀਂ ਜਮਾਤ ਅੱਸੀ ਪ੍ਰਸੈਂਟ ਨਾਲ਼ ਪਾਸ ਕੀਤੀ ਹੈ ਅਤੇ ਮੈਂ ਬਾਰ੍ਹਵੀਂ ਵਿੱਚ ਨੋਨ ਮੈਡੀਕਲ ਨਾਲ਼ ਵ ਅੰਕ ਨੱਬੇ ਪ੍ਰਸੈਂਟ ਨਾਲ ਪਾਸ ਕੀਤੀ ਹੈ ਅਤੇ ਮੇਰੇ ਮਾਤਾ ਪੀ ਮਾਤਾ ਜੀ ਦਾ ਨਾਮ ਕਮਲਾ ਦੇਵੀ ਹੈ ਜੋ ਕਿ ਇੱਕ ਕੁਸ਼ਲ ਗ੍ਰਹਿਣੀ ਹਨ ਅਤੇ ਮੇਰੇ ਪਿਤਾ ਜੀ ਦਾ ਨਾਮ ਜਸਵੀਰ ਸਿੰਘ ਹਨ ਉਹ ਇੱਕ ਕਿਸਾਨ ਹਨ ਉਹ ਭਾਰਤ ਦੀ ਖੇਤੀਬਾੜੀ ਵਿੱਚ ਬਹੁਤ ਹੀ ਜ਼ਿਆਦਾ ਸਹਿਯੋਗ ਕਰਦੇ ਹਨ ਅਤੇ ਮੈਂ ਵੱਡੀ ਹੋ ਕੇ ਟੀਚਰ ਬਣਨਾ ਅਧਿਆਪਕ ਬਣਨਾ ਚਾਹੁੰਦੀ ਹਨ ਅਤੇ ਸਿੱਖਿਆ ਨੂੰ ਵੱਧ ਤੋਂ ਵੱਧ ਫੈਲਾਉਣਾ ਚਾਹੁੰਦੀ ਹਨ ਅਤੇ ਮੈਂ ਹੁਣ ਇਸ ਟਾਈਮ ਬੀ ਟੈਕ ਸੀ ਐੱਸ ਸੀ ਕੋਐਸ਼ ਗਰੁੱਪ ਔਫ ਇੰਸਚੀਟਿਊਸ਼ਨ ਤੋਂ ਕਰ ਰਹੀ ਹਨ ਅਤੇ ਮੈਂ ਆਪਣਾ ਮੈਂ ਮੈਂ ਆਪਣੇ ਮਾਪਿਆਂ ਦੀ ਇਕਲੋਤੀ ਧੀ ਹਨ ਧੀ ਹਾਂ ਅਤੇ ਮੈਂ ਚਾਹੁੰ ਮੈਂ ਆਪਣੇ ਮਾ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨਾ ਚਾਹੁੰਦੀ ਹਨ ਅਤੇ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੀ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਕੇ ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਸਾਰੇ ਫੈਸਲਿਆਂ ਤੋਂ ਖੁਸ਼ ਰਹਿਣ ਅਤੇ ਮੈਂ ਆਪਣੇ ਬਾਰੇ ਬਸ ਐਨਾ ਕੁ ਹੀ ਦੱਸਣਾ ਚਾਹੁੰਦੀ ਹਾਂ